ਸਾਨੂੰ ਪਾਣੀ ਦੀ ਸਪਲਾਈ ਤਾਂ ਮਿਲਦੀ ਹੈ ਰੋਜ਼ਾਨਾ ਹੀ ਮਿਲਦੀ ਹੈ ਪਾਣੀ ਦੀ ਸਪਲਾਈ ਪਰ ਉਹ ਪਾਣੀ ਬਹੁਤ ਹੀ ਗੰਦਾ ਹੁੰਦਾ ਹੈ ਕਈ ਵਾਰੀ ਤਾਂ ਪਾਣੀ ਬਹੁਤ ਹੀ ਘੱਟ ਆਉਂਦਾ ਹੈ ਕਈ ਕਈ ਵਾਰੀ ਤਾਂ ਪਿੱਛੋਂ ਮੋਟਰ ਹੀ ਨਹੀਂ ਚਲਦੀ ਜਿਹਦੇ ਨਾਲ ਪਾਣੀ ਦੀ ਸਪਲਾਈ ਬੰਦ ਹੋ ਜਾਂਦੀ ਹੈ ਅਤੇ ਕਈ ਕਈ ਵਾਰੀ ਦੋ ਤਿੰਨ ਦਿਨ ਪਾਣੀ ਨਹੀਂ ਆਇਆ ਹੈ ਪਿਛਲੇ ਦਿਨਾਂ ਦੀ ਗੱਲ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਪਾਣੀ ਦੀ ਸਪਲਾਈ ਇੰਨੀ ਘੱਟ ਹੋ ਗਈ ਸੀ ਕਿ ਦੋ ਦਿਨ ਪਾਣੀ ਹੀ ਨਹੀਂ ਆਇਆ ਜਿਨ੍ਹਾਂ ਦੇ ਘਰ ਤਾਂ ਬੋਰ ਲੱਗੇ ਹੋਏ ਸੀ ਤਾਂ ਉਹਨਾਂ ਦੀਆਂ ਮੋਟਰਾਂ ਛਡਵਾ ਛਡਵਾ ਕੇ ਅਸੀਂ ਨਾਲ ਦੇ ਘਰੋਂ ਪਾਣੀ ਮੰਗ ਮੰਗ ਕੇ ਆਪਣੀ ਟੈਂਕੀ ਵਿੱਚ ਪਵਾ ਕੇ ਤਾਂ ਉਹ ਹੀ ਅਸੀਂ ਇਸਤੇਮਾਲ ਕੀਤਾ ਪਾਣੀ ਦੀ ਸਪਲਾਈ ਤਾਂ ਮਿਲਦੀ ਹੈ ਪਰ ਘੱਟ ਮਿਲਦੀ ਹੈ ਅਤੇ ਜੇ ਟੂਟੀ ਦਾ ਪਾਣੀ ਆਉਂਦਾ ਵੀ ਹੈ ਤਾਂ ਉਹ ਪਾਣੀ ਇੰਨਾ ਕੁ ਜ਼ਿਆਦਾ ਗੰਦਾ ਹੁੰਦਾ ਹੈ ਕਈ ਵਾਰੀ ਤਾਂ ਕਾਲਾ ਜਿਹਾ ਪਾਣੀ ਆਉਂਦਾ ਹੈ ਜਿਹੜਾ ਗਟਰਾਂ ਦੇ ਬਦਬੂ ਦਿੰਦਾ ਹੈ ਇਹ ਪਾਣੀ ਇੰਨਾ ਗੰਦੇ ਹੋਣ ਦੇ ਕਾਰਨ ਹੀ ਸਾਡੇ ਪਾਣੀ ਦੀ ਸਪਲਾਈ ਮਿਲਦੀ ਹੈ ਪਰ ਗੰਦੀ ਮਿਲਦੀ ਹੈ ਅਤੇ ਸਾਡਾ ਜੀਵਨ ਵੀ ਇੰਨਾ ਜ਼ਿਆਦਾ ਆਮ ਜੀਵਨ ਨਾਲੋਂ ਵੱਖਰਾ ਹੁੰਦਾ ਹੈ ਕਿਉਂਕਿ ਕਦੇ ਸਾਨੂੰ ਉਲਟੀਆਂ ਲੱਗ ਜਾਂਦੀਆਂ ਹਨ ਸਾਡੀਆਂ ਪੋਟੀਆਂ ਲੱਗ ਜਾਂਦੀਆਂ ਹਨ ਇਹ ਪਾਣੀ ਦੇ ਨਾਲ ਸਾਡੇ ਸ ਪੇਟ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਉਤਪੰਨ ਹੋ ਜਾਂਦੀਆਂ ਹਨ ਸਾਡਾ ਪਾਣੀ ਕਦੇ ਵੀ ਸਾਫ਼ ਆਉਂਦਾ ਹੀ ਨਹੀਂ ਹੈ ਪਾਣੀ ਦੇ ਸਾਫ਼ ਨਾ ਆਉਣ ਦੇ ਕਾਰਨ ਹੀ ਕਈ ਵਾਰੀ ਅਸੀਂ ਜਦੋਂ ਅਸੀਂ ਭਾਂਡੇ ਪੀਣ ਵਾਲੇ ਪਾਣੀ ਨੂੰ ਸਾਨੂੰ ਉਬਾਲ ਕਰਕੇ ਰੱਖਣਾ ਪੈਂਦਾ ਹੈ ਸਾਨੂੰ ਐਕਵਾਗਾਰਡ ਵਗੈਰਾ ਇਹੋ ਜਿਹੀਆਂ ਚੀਜ਼ਾਂ ਦਾ ਇਸਤੇਮਾਲ ਕਰਨਾ ਪੈਂਦਾ ਹੈ ਤਾਂ ਕਿ ਸਾਡਾ ਪਾਣੀ ਸਾਫ਼ ਹੋ ਸਕੇ ਉਸ ਪਾਣੀ ਕਈ ਵਾਰੀ ਤਾਂ ਇੰਨਾ ਗੰਦਾ ਪਾਣੀ ਆਉਂਦਾ ਹੈ ਕਿ ਉਸ ਐਕਵਾਗਾਰਡ ਨੂੰ ਸਾਨੂੰ ਦੁਬਾਰਾ ਦੁਬਾਰਾ ਤੋਂ ਕਈ ਮਹੀਨੇ ਵਿੱਚ ਦੋ ਦਿਨ ਵਾਰੀ ਸਾਨੂੰ ਉਹਦੀ ਸਫ਼ਾਈ ਕਰਵਾਉਣੀ ਪੈਂਦੀ ਹਨ ਪਾਣੀ ਸਾਡੇ ਜੀਵਨ ਦੀ ਅਡਮੁਲੀ ਬਹੁਮੁਲੀ ਦੇਣ ਹੈ ਇਸ ਪਾਣੀ ਨੂੰ ਤੁਸੀਂ ਹਰ ਇਨ ਇਨਸਾਨ ਤੋਂ ਪਾਣੀ ਤੋਂ ਬਗੈਰ ਰਹਿ ਹੀ ਨਹੀਂ ਸਕਦਾ ਹੈ ਪਰ ਪਾਣੀ ਦੀ ਸਰਕਾਰ ਨੂੰ ਸਪਲਾਈ ਚੰਗੀ ਕਰਨੀ ਚਾਹੀਦੀ ਹੈ ਪਾਣੀ ਦੀ ਸਪਲਾਈ ਸਾਨੂੰ ਚੰਗੀ ਤਰ੍ਹਾਂ ਰੋਜ਼ਾਨਾ ਮਿਲਦੀ ਰਹਿਣੀ ਚਾਹੀਦੀ ਹਨ ਟੂਟੀ ਜੇ ਅਸੀਂ ਟੂਟੀ ਦੇ ਪਾਣੀ ਤੋਂ ਇਲਾਵਾ ਅਸੀਂ ਆਪਣਾ ਬੋਰ ਵਾਲਾ ਪਾਣੀ ਵਰਤੀਏ ਤੁਸੀਂ ਦੇਖੋ ਅੱਜ ਕੱਲ੍ਹ ਤਾਂ ਥੱਲੇ ਜ਼ਮੀਨ ਦੇ ਥੱਲੇ ਤੱਕ ਪਾਣੀ ਦੀ ਡੂੰਘਾਈ ਇੰਨੀ ਜ਼ਿਆਦਾ ਘੱਟ ਹੋ ਚੁੱਕੀ ਹੈ ਕਿ ਥੱਲੇ ਤੱਕ ਬੋਰ ਕਰਵਾਉਣਾ ਪੈਂਦਾ ਹੈ ਉਹ ਪਾਣੀ ਸਾਫ਼ ਆਉਂਦਾ ਹੈ ਉਹ ਪਾਣੀ ਦਾ ਦੂਸਰਾ ਪਾਣੀ ਸਾਫ਼ ਆਉਂਦਾ ਹੈ ਜਿਹਦੇ ਨਾਲ ਅਸੀਂ ਪੀਣ ਵਾਲਾ ਪਾਣੀ ਇਸਤੇਮਾਲ ਕੋਲ ਅੱਜ ਕੱਲ੍ਹ ਕਦੇ ਵੀ ਪੀਣ ਵਾਲਾ ਪਾਣੀ ਅਸੀਂ ਐਕਵਾਗਾਰਡ ਤੋਂ ਬਗੈਰ ਯੂਜ਼ ਹੀ ਇਸਤੇਮਾਲ ਹੀ ਨਹੀਂ ਕਰ ਸਕਦੇ ਹਨ ਕਿਉਂਕਿ ਉਹ ਪਾਣੀ ਬਹੁਤ ਹੀ ਗੰਦਾ ਆਉਂਦਾ ਹੈ ਇਸ ਕਰਕੇ ਸਾਨੂੰ ਪਾਣੀ ਸਾਫ਼ ਹੀ ਪੀਣਾ ਚਾਹੀਦਾ ਹੈ ਅਤੇ ਟੂਟੀ ਦਾ ਪਾਣੀ ਸਾਨੂੰ ਸਫ਼ਾਈ ਸਪਲਾਈ ਸਾਨੂੰ ਚੰਗੀ ਤਰਾਂ ਮਿਲਦੀ ਹੀ ਨਹੀਂ ਹੈ